ਇੱਕ ਨਕਾਰਾਤਮਕ ਤਜਰਬੇ ਮੈਨੂੰ ਮੇਰੇ ਦੂਜੇ ਉਤਪਾਦ ਇੱਕ ਸਮਾਟਫੋਨ ਨਾਲ ਹੋਇਆ ਸੀ ਜਿਸ ਵਿੱਚ ਅਕਸਰ ਸੋਫਟਵੇਅਰ ਗੜਬੜੀਆਂ ਅਤੇ ਪ੍ਰਦਰਸ਼ਨ ਦੀਆਂ ਸਮੱਸਿਆਵਾਂ ਸ਼ਾਮਲ ਹੁੰਦੀਆਂ ਸੀ ਸ਼ੁਰੂ ਵਿੱਚ ਫੋਨ ਆਪਣੇ ਪਤਲੇ ਡਿਜੈਨ ਅਤੇ ਉੱਨਤ ਵਿਸ਼ੇਸ਼ਤਾਵਾਂ ਦੇ ਨਾਲ ਸ਼ਾਨਦਾਰ ਜਾਪਦਾ ਸੀ ਪਰ ਸਮੇਂ ਦੇ ਨਾਲ ਇਹ ਬਹੁਤ ਘੱਟ ਐਪਲੀਕੇਸ਼ਨ ਦੇ ਚਲਦੇ ਹੋਏ ਵੀ ਕਾਫ਼ੀ ਪੱਛੜ ਗਿਆ ਅਪ੍ਰੇਟਿੰਗ ਸਿਸਟਮ ਅਕਸਰ ਫ੍ਰੀਜ ਹੋ ਜਾਂਦਾ ਹੈ ਜਿਸ ਨਾਲ ਨਾਜ਼ੁਕ ਪਲਾਂ ਦੌਰਾਨ ਨਿਰਾਸ਼ਾ ਪੈਦਾ ਹੁੰਦੀ ਹੈ ਇਸ ਤੋਂ ਇਲਾਵਾ ਬੈਟਰੀ ਲਾਈਫ ਉਮੀਦ ਨਾਲੋਂ ਤੇਜ਼ੀ ਨਾਲ ਵਿਗੜ ਗਈ ਜਿਹਦੇ ਨਾਲ ਦਿਨ ਭਰ ਕਈ ਰੀਚਾਰਜ ਕਰਨੇ ਪੈਂਦੇ ਸੀ ਜੋ ਕਿ ਅਸੁਵਿਧਾਜਨਕ ਸੀ ਕਈ ਸੋਫਟਵੇਅਰ ਅਪਡੇਟਾਂ ਅਤੇ ਸਮੱਸਿਆਵਾਂ ਨਿਪਟਾਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਮੁੱਦੇ ਬਰਕਰਾਰ ਸ ਹਨ ਸਮੁੱਚੇ ਉਪਭੋਗਤਾ ਅਨੁਭਵ ਨੂੰ ਪ੍ਰਭਾਵਿਤ ਕਰਦੇ ਹੋਏ ਗਾਹਕ ਸਹਾਇਤਾ ਵੀ ਉਮੀਦ ਨਾਲੋਂ ਘੱਟ ਜਵਾਬਦੇਹ ਸੀ ਜਿਸ ਨਾਲ ਸਮੱਸਿਆਵਾਂ ਨੂੰ ਕੁਸ਼ਲਤਾ ਨਾਲ ਹੱਲ ਕਰਨਾ ਮੁਸ਼ਕਲ ਹੋ ਗਿਆ ਸੀ ਪ੍ਰਦਰਸ਼ਨ ਦੇ ਮੁੱਦਿਆਂ ਅਤੇ ਸਮਰਥਨ ਦੇ ਇਸ ਸੁਮੇਲ ਨੇ ਇੱਕ ਨਿਰਾਸ਼ਾਜਨਕ ਅਨੁਭਵ ਲਿਆ ਖ਼ਾਸ ਤੌਰ 'ਤੇ ਸ਼ੁਰੂਆਤ ਵਿੱਚ ਉਮੀਦਾਂ ਨੂੰ ਦੇਖਦੇ ਹੋਏ